ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਘੁੰਮਣ ਫਿਰਨ ਦਾ ਸ਼ੌਂਕ ਰੱਖਦੇ ਯਾਤਰਾ ਜਾਣ ਦਾ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਰੱਖਦੇ ਯਾਤਰਾ ਤੇ ਜਾਣ ਦਾ ਬਹੁਤ ਸ਼ੌਂਕ ਰੱਖਦਾ ਏ ਇਸੇ ਤਰ੍ਹਾਂ ਹੀ ਅਸੀਂ ਆਪਣੀ ਫੈਮਲੀ ਯਾਰ ਦੋਸਤ ਇਕੱਠੇ ਹੋ ਕੇ ਪਲਾਨ ਬਣਾਇਆ ਹਰਿਮੰਦਰ ਸਾਹਿਬ ਜਾਣ ਦਾ ਤੇ ਅਸੀਂ ਵੀਹ ਸੀਟਰਡ ਬੱਸ ਦਾ ਅਰੇਂਜ ਕੀਤਾ ਤੇ ਅਸੀਂ ਜਾ ਕੇ ਉਹ ਡਰਾਈਵਰ ਨੂੰ ਮਿਲੇ ਉਹਦੀ ਦਿਹਾੜੀ ਪੁੱਛੀ ਤੇ ਅਸੀਂ ਆਪਣਾ ਅੰਮ੍ਰਿਤਸਰ ਜਾਣ ਵਾਸਤੇ ਤਿਆਰ ਹੋ ਗਏ ਔਰ ਜਦੋਂ ਅੰਮ੍ਰਿਤਸਰ ਗਏ ਉਥੇ ਹਰਿਮੰਦਰ ਸਾਹਿਬ ਗਏ ਮੱਥਾ ਟੇਕਿਆ ਫਿਰ ਲੰਗਰ ਹਾਲ ਗਏ ਲੰਗਰ ਹਾਲ ਮੱਥਾ ਟੇਕਿਆ ਲੰਗਰ ਹਾਲ ਗਏ ਫੇਰ ਅਸੀਂ ਅਜਾਇਬ ਘਰ ਦੇਖਿਆ ਫਿਰ ਉਥੋਂ ਅਸੀਂ ਜਲਿਆਂ ਵਾਲੇ ਬਾਗ ਵਿੱਚ ਦਾ ਆਪਣਾ ਇਤਿਹਾਸਿਕ ਚਿੰਨ੍ਹ ਦੇਖਾਂਗੇ ਫਿਰ ਉਥੋਂ ਅਸੀਂ ਬਾਗਾ ਬਾਰਡਰ ਤੇ ਜਿਥੇ ਆਪਣਾ ਪਰੇਡ ਹੁੰਦੀ ਹੈ ਪਾਕਿਸਤਾਨ ਆਪਣੇ ਇੰਡੀਆ ਦੀ ਉਹ ਦੇਖਣ ਚਲੇ ਗਏ ਫਿਰ ਉਥੋ ਨੈਨਾ ਦੇਵੀ ਮੰਦਿਰ ਮੰਦਰ ਦੇਖਣ ਚਲ ਗਏ ਉਥੋਂ ਅਸੀਂ ਨਾਲ ਹੀ ਗੋਇੰਦਵਾਲ ਸਾਹਿਬ ਚੱਲ ਗਏ ਉੱਥੇ ਵੀ ਇਤਿਹਾਸਿਕ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ ਤੇ ਇਤਿਹਾਸਿਕ ਚੀਜ਼ਾਂ ਬਹੁਤ ਦੇਖਣ ਉਸ ਤੋਂ ਬਾਅਦ ਅਸੀਂ ਰਾਮ ਤੀਰਥ ਮੰਦਰ ਚਲੇ ਗਏ ਉਥੋਂ ਉਥੇ ਬਹੁਤ ਵੱਡਾ ਸਰੋਵਰ ਹੈ ਉੱਥੇ ਵੀ ਅਸੀਂ ਇਸ਼ਨਾਨ ਕੀਤਾ ਤੇ ਸਾਨੂੰ ਬਹੁਤ ਜਿਆਦਾ ਆਨੰਦ ਆਇਆ ਤੇ ਅਸੀਂ ਅੱਗੇ ਵੀ ਆਪਣਾ ਪਲਾਨ ਬਣਾ ਰਹੇ ਹਾਂ ਕਿ ਬੱਚਿਆਂ ਨੂੰ ਲੈ ਕੇ ਕਿਤੇ ਧਾਰਮਿਕ ਸਥਾਨਾਂ ਤੇ ਹੋਰ ਵੀ ਕਿਤੇ ਜਾਈਏ